ਸ਼ਹੀਦ ਭਗਤ ਸਿੰਘ ਨਗਰ ਵਿੱਚ ਵੈਸੇ ਤਾਂ ਇਤਿਹਾਸਕਾਰ ਸਥਾਨ ਬਹੁਤ ਹਨ ਲੇਕਿਨ ਉਹਨਾਂ ਵਿੱਚੋਂ ਮੈਂ ਤੁਹਾਨੂੰ ਕੁਝ 'ਤੇ ਹੀ ਚਾਨਣਾ ਪਾਊਂਗਾ ਅਤੇ ਪਹਿਲਾਂ ਆਪਾਂ ਸਥਾਨ ਦੀ ਗੱਲ ਕਰਾਂਗੇ ਸ਼ ਸ਼ਹੀਦ ਭਗਤ ਸਿੰਘ ਨਗ ਵਿੱਦਾ ਖੁਦ ਦਾ ਘਰ ਪੁਰਾਣਾ ਜੱਦੀ ਘਰ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਅਤੇ ਜਿੱਥੋਂ ਉਹਨਾਂ ਨੂੰ ਆਪਣੇ ਜਲਿਆਂਵਾਲਾ ਬਾਗ ਦੇ ਦਾ ਉਹਨਾਂ ਨੇ ਕਤਲਕਾਂਡ ਦੇਖਿਆ ਅਤੇ ਉਸ ਤੋਂ ਬਾਅਦ ਉਹਨਾਂ ਦੇ ਯਾ ਯਾਦ ਦੇ ਵਿੱਚ ਉਹਨਾਂ ਦੇ ਪਿੰਡ ਦੇ ਬਾਹਰ ਰੋਡ ਦੇ ਉੱਪਰ ਖਟਖੜ ਕਲਾ ਦੇ ਪਿੰਡ ਦੇ ਰ ਬੱਸ ਸਟੈਂਡ ਦੇ ਉੱਤੇ ਉਹਨਾਂ ਦੇ ਯਾਦਗਾਰ ਦੇ ਤੌਰ ਦੇ ਵਿੱਚ ਇੱਕ ਮਿਊਜ਼ੀਅਮ ਵੀ ਤਿਆਰ ਕੀਤਾ ਹੋਇਆ ਏ ਜਿੱਥੇ ਉਹਨਾਂ ਦੇ ਕੁਝ ਵਸਤਰ ਕੱਪੜੇ ਅਤੇ ਉਹਨਾਂ ਦਾ ਕੁਝ ਸਮਾਨ ਰੱਖਿਆ ਹੋਇਆ ਏ ਅਤੇ ਜੋ ਆਪਣੇ ਸ਼ਹੀਦੀ ਵਾਸਤੇ ਅ ਆਪਣੇ ਭਾਰਤ ਵਾਸਤੇ ਜੋ ਸ਼ਹੀਦ ਹੋਏ ਹੈ ਉਹਨਾਂ ਦੀ ਯਾਦਗਾਰਾਂ ਦੇ ਵਿੱਚ ਵੀ ਸਮਾਨ ਰੱਖਿਆ ਗਿਆ ਹੈ ਅਤੇ ਸ਼ਹੀਦ ਭਗਤ ਸਿੰਘ ਦਾ ਜਿਹੜਾ ਜੱਦੀ ਘਰ ਹੈ ਉੱਥੇ ਉਹਨਾਂ ਦੇ ਪਿਤਾ ਮਾਤਾ ਅਤੇ ਖੁਦ ਸ਼ਹੀਦ ਭਗਤ ਸਿੰਘ ਜੀ ਨੇ ਆਪਣਾ ਟਾਈਮ ਸਪੈਂਡ ਕੀਤਾ ਸੀ ਅਤੇ ਜਿੱਥੋਂ ਉਹਨਾਂ ਨੂੰ ਅੱਗੇ ਆਪਣਾ ਉਹਨਾਂ ਨੇ ਆਪਣਾ ਫਿਊਚਰ ਸੋਚਿਆ ਫਿਊਚਰ ਆਪਾਂ ਉਹਨਾਂ ਨੇ ਸੋਚਿਆ ਕਿ ਮੈਂ ਦੇਸ਼ ਲਈ ਕੀ ਕਰ ਸਕਦਾਂ ਕੀ ਕਰ ਨਹੀਂ ਬਾਕੀ ਤਾਂ ਤੁਸੀਂ ਸਭ ਜਾਣਦੇ ਹੀ ਹੋ ਕਿ ਸ਼ਹੀਦ ਭਗਤ ਸਿੰਘ ਜੀ ਨੇ ਕੀ ਕੀਤਾ ਹੈ ਕੀ ਨਹੀਂ ਕੀਤਾ ਏ ਅਤੇ ਹੁਣ ਆਪਾਂ ਦੂਜੀ ਗੱਲ ਕਰਾਂਗੇ ਬਾਬਾ ਬੰਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਠੀਕ ਹੈ ਅਤੇ ਆਪਾਂ ਉਹਨਾਂ ਦੇ ਰ ਪਿੰਡ ਰੈਲ ਮਾਜਰਾ ਵਿਖੇ ਰੈਲ ਮਾਜਰਾ ਜਦੋਂ ਆਪਾਂ ਪਾਰ ਕਰ ਲੈਂਦੇ ਹਾਂ ਵਿੱਚ ਨੂੰ ਜਾ ਕੇ ਐਂਡ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਗੁਪਤ ਗੁਫਾਵਾਂ ਬਣੀਆਂ ਹੋਈਆਂ ਨੇ ਜਿੱਥੇ ਅੱਜ ਵੀ ਲੋਕ ਉਸ ਗੁਫਾਵਾਂ ਨੂੰ ਦੂਰ ਦੂਰ ਤੋਂ ਦੇਖਣ ਨੂੰ ਆਉਂਦੇ ਹਨ ਉਹ ਗੁਫਾਵਾਂ ਜਦੋਂ ਆਪਾਂ ਉਸ ਗੁਫਾਵਾਂ ਵਿੱਚ ਐਂਟਰ ਹੋ ਜਾਂਦੇ ਹਾਂ ਅਤੇ ਉਹ ਕਿੱਧਰ ਤੋਂ ਕਿੱਧਰ ਨੂੰ ਨਿਕਲਦੀਆਂ ਹਨ ਉਹ ਅਸੀਂ ਵੀ ਨਹੀਂ ਜਾਣਦੇ ਅਤੇ ਉਹ ਗੁਫਾਵਾਂ ਬਹੁਤ ਹੀ ਲੰਬੀਆਂ ਹਨ ਅਤੇ ਗੁਫਾਵਾਂ ਜਿਹੜੀਆਂ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਛੋਟਾ ਜਿਹਾ ਇੱਕ ਗੁਰਦੁਆਰਾ ਸਾਹਿਬ ਵੀ ਬਣਾਇਆ ਹੋਇਆ ਏ ਉੱਥੋਂ ਦੂਰੋਂ ਬਹੁਤ ਸੈਲਾਨੀ ਉਸ ਗੁਫਾਵਾਂ ਨੂੰ ਦੇਖਣ ਆਉਂਦੇ ਹਨ ਆਪਾਂ ਤੀਜੀ ਗੱਲ ਕਰਾਂਗੇ ਸ਼ਹੀਦ ਭਗਤ ਸਿੰਘ ਨਗਰ ਦੀ ਇਸ ਵਿੱਚ ਇੱਕ ਚੀਜ਼ ਹੋਰ ਆਪਾਂ ਨੂੰ ਮਹੱਤਵਪੂਰਨ ਆਕਰਸ਼ਣ ਦੇਖਣ ਨੂੰ ਮਿਲਦੀ ਹੈ ਜੋ ਕਿ ਹੈ ਮਹਾਰਾਜਾ ਰਣਜੀਤ ਸਿੰਘ ਦਾ ਖੁਦ ਦਾ ਹੱਥੀ ਗੱਡਿਆ ਹੋਇਆ ਝੰਡਾ ਜਿਹਨੂੰ ਆਪਾਂ ਨਿਸ਼ਾਨੀ ਦੇ ਤੌਰ 'ਤੇ ਕਹਿ ਸਕਦੇ ਹੈ ਕਿ ਕਿਸੇ ਕਿਸਮ ਦਾ ਉਸ ਟਾਈਮ ਦੇ ਵਿੱਚ ਪੁਰਾਣੇ ਜਮਾਨੇ ਦੇ ਵਿੱਚ ਉਹ ਉੱਥੇ ਤੱਕ ਉਹਨਾਂ ਨੇ ਆਪਣਾ ਸਿੱਖਾਂ ਦਾ ਰਾਜ ਲਿਆ ਸੀ ਉੱਥੇ ਉਹਨਾਂ ਦੀ ਪੋਸਟ ਵੀ ਤੈਨਾਤ ਸੀ ਅਤੇ ਉਹ ਝੰਡਾ ਭਿੰਡਰ ਨਗਰ ਪਿੰਡ ਦੇ ਨਾਲ ਹੀ ਪੰਜ ਸੌ ਮੀਟਰ ਦੇ ਨਾਲ ਹੀ ਸਥਿਤ ਹੈ ਉਸ ਨੂੰ ਉਹ ਸਵਰਾਜ ਫੈਕਟਰੀ ਦੇ ਸੌ ਮੀਟਰ ਰਾਈਟ ਸਾਈਡ ਸਥਿਤ ਹੈ ਜਿੱਥੇ ਸਵਰਾਜ ਫੈਕਟਰੀ ਦੀ ਭਿੰਡਰ ਨਗਰ ਦੀ ਪੋਸਟ ਵੀ ਬਣੀ ਹੋਈ ਹੈ ਭਿੰਡਰ ਨਗਰ ਗਰਾਊਂਡ ਅਤੇ ਉਸ ਝੰਡੇ ਨੂੰ ਅੱਜ ਵੀ ਦੇਖਣ ਨੂੰ ਬਹੁਤ ਹੀ ਲੋਕ ਸੈਲਾਨੀ ਬਹੁਤ ਦੂਰ ਦੂਰ ਤੋਂ ਆਉਂਦੇ ਹਨ ਉੱਥੇ ਕੋਈ ਵੀ ਗੁਰਦੁਆਰਾ ਸਾਹਿਬ ਸਥਿਤ ਨਹੀਂ ਹੈ ਉੱਥੇ ਆਮ ਤੌਰ 'ਤੇ ਬੈਠਣ ਨੂੰ ਵਧੀਆ ਪ੍ਰਬੰਧ ਬਣਾਇਆ ਹੋਇਆ ਏ ਜੰਗਲ ਦੇ ਵਿੱਚ ਉਹ ਪ ਬਣਾਈ ਹੋਈ ਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਪੋਸਟ ਬਾਕੀ ਆਪਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਆਪਣਾ ਸ਼ਹੀਦ ਭਗਤ ਸਿੰਘ ਦੀ ਬੀ ਨਗਰ ਦੇ ਵਿੱਚ ਹੋਰ ਵੀ ਵਾਧੂ ਬਹੁਤ ਹੀ ਜ਼ਿਆਦਾ ਜਗ੍ਹਾਵਾਂ ਹਨ ਦੇਖਣ ਨੂੰ ਧੰਨਵਾਦ